ਹੈਲੋ ਵਧੀਆ ਵਧੀਆ ਭਾਅ ਜੀ ਤੁਸੀਂ ਸੁਣਾਓ ਕਿਵੇਂ ਹੋ ਬਾ ਚੱਲਣਾ ਕੀ ਆ ਹੁਣ ਜਾ ਕੇ ਜੀਰੀ ਆ ਉਹ ਫ਼ਸਲ ਵੱਢ ਕੇ ਆਇਆ ਹਲੇ ਤਾਂ ਮਸ਼ੀਨ ਮਸ਼ੂਨ ਵਿਹਲੀ ਹੋਈ ਆ ਹੁਣ ਅਸੀਂ ਬੈਠੇ ਹਾਂ ਚਾਹ ਪਾਣੀ ਪੀ ਪੀ ਰਹੇ ਹਾਂ ਹੋਰ ਉਹ ਤਾਂ ਵੀਰੇ ਕੀ ਦੱਸੀਏ ਇਹਦਾ ਨਾ ਬੁਰਾ ਹਾਲ ਕਰ ਰੱਖਿਆ ਜਿਹੜਾ ਧਰਤੀ ਦੇ ਨੰਬ ਤਾਪਮਾਨ ਵੱਧਦਾ ਜਾਂਦਾ ਨਾ ਗਲੋਬਲ ਵਾਰਮਿੰਗ ਕਰਕੇ ਜਲੂਸ ਕੱਢਿਆ ਪਿਆ ਓ ਹੋ ਬਾਹਲੀ ਜ਼ਿਆਦਾ ਦਿੱਕਤ ਵਧ ਗਈ ਉਹ ਹੀ ਦਿੱਕਤ ਆ ਵਿਆਹ ਦਾ ਇਕੱਲੇ ਦਾ ਕਰਜ਼ਾ ਹੀ ਬਹੁਤ ਆ ਜਾਣਾ ਹੋਰ ਸਾਡੇ ਤਾਂ ਆਪਣੇ ਵੀਰੇ ਇੰਨਾ ਐਤਕੀਂ ਕੰਮ ਵੱਧ ਗਿਆ ਨਾ ਅਤੇ ਕਿਸੇ ਨੂੰ ਕੀ ਦੱਸੀਏ ਅਸੀਂ ਉਹ ਕਰਵਾਇਆ ਸੀਗਾ ਮਸ਼ੀਨ ਲਾਈ ਅਸੀਂ ਵੱਢਣ 'ਤੇ ਜਦੋਂ ਫ਼ਸਲ ਦੇਖੀ ਅੱਧੀ ਸਾਡੀ ਘੱਟੋ ਘੱਟ ਅੱਧੇ ਤੋਂ ਡੇਢ ਕਿੱਲਾ ਤਾਂ ਉਹਨੇ ਖ਼ਰਾਬ ਕਰਤਾ ਸਾਡਾ ਮੀਂਹ ਨੇ ਅਤੇ ਸਾਰੀ ਫ਼ਸਲ ਬਿਠਾ ਦਿੱਤੀ ਅਤੇ ਉਹ ਸਾਰੇ ਫ਼ਸਲ ਪਹਿਲਾਂ ਹੱਥ ਨਾਲ ਵੱਢੀ ਉਸ ਤੋਂ ਬਾਅਦ ਜਦੋਂ ਸਾਰੀ ਫ਼ਸਲ ਵੱਡੀ ਉਹ ਦਿੱਕਤ ਆਂਏਂ ਆ ਕਿ ਮਸ਼ੀਨ ਦਾ ਪਾਓ ਵੱਧ ਲੱਗ ਤੇਲ ਵੱਧ ਲੱਗ ਗਿਆ ਫਿਰ ਫ਼ਸਲ ਇੰਨੀ ਕਿਉਂਕਿ ਉਹ ਹੋਇਆ ਕਣਕਾਂ ਨੂੰ ਉਹ ਚਾਹੀਦਾ ਹੁੰਦੇ ਐਤਕੀਂ ਧੁੰਦ ਵੱਧ ਚਾਹੀਦੀ ਹੁੰਦੀ ਹੈ ਅਤੇ ਐਤਕੀਂ ਮੌਸਮ ਇਹੋ ਜਿਹਾ ਹੋਇਆ ਧੁੰਦ ਹੋਈ ਨਹੀਂ ਹੈਗੀ ਬਾਹਲੀ ਫ਼ਸਲ ਦਾ ਅਤੇ ਨਿਕਲ ਗਿਆ ਜਲੂਸ ਬੜਾ ਜ਼ਿਆਦਾ ਭਾਅ ਜੀ ਬੜਾ ਜ਼ਿਆਦਾ ਅਤੇ ਉਹ ਹੀ ਕੀਤਾ ਨਾ ਹੁਣ ਐਤਕੀਂ ਉਹ ਕੀਤਾ ਜਦੋਂ ਅਸੀਂ ਦੇਖਿਆ ਫ਼ਸਲ 'ਚ ਧੁੰਦ ਨਹੀਂ ਵਧਿਆ ਪ੍ਰੋਪਰ ਵੀ ਫ਼ਸਲ ਹੋਈ ਨਹੀਂ ਹੈਗੀ ਵਧੀਆ ਅਤੇ ਜਾ ਕੇ ਜਦੋਂ ਰੇਟ ਪੁੱਛਿਆ ਉਹ ਕਹਿੰਦੇ ਸੌ ਸਿੱਧਾ ਹੀ ਤੁਹਾਨੂੰ ਸੌ ਹੋਰ ਰੇਟ ਪੂਰਾ ਪਿਆ ਹੀ ਨਹੀਂ ਰੇਟ ਪੂਰਾ ਹੀ ਨਹੀਂ ਪਿਆ ਅਸੀਂ ਤਾਂ ਆਪ ਮੂੰਹ ਵੱਲ ਦੇਖੀਏ ਵੀ ਆਹ ਕੀ ਬਣ ਗਿਆ ਸਾਡਾ ਹੁਣ ਨਾ ਪੈਸੇ ਕਿਸੇ ਪਾਸੋਂ ਮੰਗਣ ਜੋਗੇ ਨਾ ਕਹਿਣ ਜੋਗੇ ਨਾ ਕਿਸੇ ਨੂੰ ਬੋਲਣ ਜੋਗੇ ਹੁਣ ਕੀ ਕਰਿਆ ਆਪਣੀ ਫ਼ਸਲ ਹੀ ਨਹੀਂ ਇਹੋ ਜਿਹੀ ਹੋਈ ਹੋਰ ਉਹੀ ਤਾਂ ਭਾਅ ਜੀ ਹੋਰ ਵੀਰੇ ਉਹ ਹੀ ਤਾਂ ਡਰ ਆ ਹੁਣ ਮੈਨੂੰ ਤੁਹਾਡਾ ਸੁਣ ਕੇ ਮੈਨੂੰ ਤਾਂ ਹੋਰ ਬਦਲ ਗਿਆ ਵੀਰੇ ਉਹ ਕਰਨਾ ਤੁਸੀਂ ਤਾਂ ਨਾਲੇ ਵਿਆਹ ਕਰਨਾ ਕੁੜੀ ਦਾ ਉਹ ਕਿਵੇਂ ਕਰੋਗੇ ਤੋ ਵੀਰੇ ਹੁਣ ਕੀ ਕਹਿ ਸਕਦੇ ਹੁਣ ਰੱਬ ਰਾਖਾ ਹੀ ਆ ਹੁਣ ਤਾਂ ਨਾ ਉਹੀ ਆ ਕਰਜ਼ਾ ਨਾਲੇ ਸਰਨਾ ਵੀ ਨਹੀਂ ਹੈਗਾ ਕਕਰਜੇ ਦੇ ਬਿਨਾਂ ਹੁਣ ਤਾਂ ਇਹਦੇ ਵਿੱਚ ਐਂਡ ਵਿੱਚ ਬੰਦਾ ਟੰਗਿਆ ਹੀ ਜਾਂਦਾ ਹੋਰ ਉਹੀ ਡਰ ਆ ਨਾ ਇਹਦਾ ਪੂਰਾ ਡਰ ਲੱਗਿਆ ਪਿਆ ਐਤਕੀਂ ਕੀ ਬਣੂ ਕੀ ਨਹੀਂ ਬਸ ਚੱਲੀ ਜਾਂਦਾ ਵੀਰੇ ਹੁਣ ਬੈਠੇ ਆ ਬਾ ਹੁਣ ਨਾਲ ਬਈਆਂ ਬੁਈਆਂ ਨੂੰ ਵੀ ਚਾਹ ਪਾਣੀ ਪਿਲਾਉਂਦੇ ਹਾਂ ਹੋਰ ਸਾਰੀ ਦਿਹਾੜੀ ਮਸ਼ੀਨ ਚਲਾਈ ਜਾਵਾਂਗੇ ਹੋਰ ਉਹੀ ਤਾਂ ਭਾਅ ਜੀ ਦਿੱਕਤ ਆ ਦਿਨੇ ਹੀ ਕਰਨਾ ਹੀ ਪੈਂਦਾ ਮੈਂ ਤਾਂ ਵਾਹ ਦੇਣੇ ਹੋਰ ਚਾਹ ਤੋਂ ਪਹਿਲਾਂ ਟਾਈਮ ਟਾਈਮ 'ਤੇ ਜੇ ਚਾਹ ਨਾ ਮਿਲੇ ਫਿਰ ਕਹਿੰਦੇ ਕੰਮ ਨਹੀਂ ਕਰਦੇ ਜਦੋਂ ਤੱਕ ਚਾਹ ਨਹੀਂ ਦਿੰਦੇ ਹੈਗੇ ਇਹ ਅੱਡ ਰੋਣ ਧੋਣ ਬਹਿ ਜਾਂਦੇ ਆ ਇਹ ਜਾਇਓ ਜਾਇਓ ਜਾਇਓ ਠੀਕ ਆ ਬਾਈ ਠੀਕ ਆ ਸਤਿ ਸ਼੍ਰੀ ਅਕਾਲ ਓਕੇ